ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਠਾਨਕੋਟ ਤੋਂ ਹਰਜੀਤ ਕੌਰ ਬੋਲ ਰਹੀ ਹਾਂ ਵੈਸੇ ਤਾਂ ਸਾਡੇ ਪੰਜਾਬ ਦੇ ਪੰਜਾਬ ਜੋ ਹੈ ਧਾਰਮਿਕ ਅਸਥਾਨਾਂ ਦੇ ਨਾਲ ਹੀ ਪ੍ਰਸਿੱਧ ਹੈ ਕਿਉਂਕਿ ਇਹ ਗੁਰੂਆਂ ਪੀਰਾਂ ਸਾਧੂ ਸੰਤਾਂ ਦੀ ਧਰਤੀ ਹੈ ਅਤੇ ਇਹ ਇੱਕ ਇਹ ਧਰਤੀ ਸਾਡੀ ਮਤਲਬ ਕਿ ਇਹਨਾਂ ਥਾਵਾਂ ਦੇ ਨਾਲ ਹੀ ਮਸ਼ਹੂਰ ਹੈ ਵੈਸੇ ਤਾਂ ਸਾਡੇ ਪੰਜਾਬ ਦੇ ਵਿੱਚ ਧਾਰਮਿਕ ਅਸਥਾਨ ਜਿਵੇਂ ਦਰਬਾਰ ਸਾਹਿਬ ਅੰਮ੍ਰਿਤਸਰ ਬਾਠ ਸਾਹਿਬ ਪਠਾਨਕੋਟ ਟਾਲੀ ਸਾਹਿਬ ਇਹ ਕਾਫੀ ਮਸ਼ਹੂਰ ਥਾਵਾਂ ਨੇ ਜਿੱਦਾਂ ਕਿ ਇੱਧਰ ਟਾਲੀ ਸਾਹਿਬ ਜੋ ਬਾਬਾ ਸ਼੍ਰੀ ਚੰਦ ਦੀ ਜਗ੍ਹਾ ਹੈ ਬਾਠ ਸਾਹਿਬ ਜੋ ਬਾਬਾ ਸ਼੍ਰੀ ਚੰਦ ਦੀ ਜਗ੍ਹਾ ਹੈ ਅਤੇ ਇੱਥੇ ਕਾਫੀ ਮੰਦਰ ਮਸਜਿਦ ਵੀ ਹਨ ਪਰ ਮਤਲਬ ਕਿ ਕਾਫੀ ਜ਼ਿਆਦਾ ਮੈਂ ਅੰਮ੍ਰਿਤਸਰ ਪਠਾਨਕੋਟ ਦੇ ਬਾਰੇ ਮੈਂ ਜਾਣਦੀ ਹਾਂ ਅਤੇ ਉੱਥੇ ਮੈਂ ਜਾਣ ਦੀ ਕੋਸ਼ਿਸ਼ ਵੀ ਕਰਦੀ ਹਾਂ ਕਿ ਮੈਂ ਵੱਧ ਤੋਂ ਵੱਧ ਉੱਥੇ ਜਾਵਾਂ ਅਤੇ ਉੱਥੇ ਗੁਰਬਾਣੀ ਅਤੇ ਗੁਰਬਾਣੀ ਸੁਣਾਂ ਅਤੇ ਉਸ ਗੁਰਬਾਣੀ ਦਾ ਮੈਂ ਆਨੰਦ ਮਾਣਾਂ ਪਰ ਕਈ ਵਾਰੀ ਕੋਈ ਸਮੇਂ ਦੇ ਕਾਰਨ ਨਹੀਂ ਨਾ ਵੀ ਜਾ ਨਹੀਂ ਵੀ ਜਾ ਸਕਦੀ ਪਰ ਮੈਂ ਵੱਧ ਤੋਂ ਵੱਧ ਇਹੀ ਕੋਸ਼ਿਸ਼ ਕਰਦੀ ਹਾਂ ਕਿ ਹਰ ਐਤਵਾਰ ਹਰ ਦਿਨ ਮੈਂ ਉਸ ਗੁਰਬਾਣੀ ਨੂੰ ਸੁਣਾਂ ਅਤੇ ਉੱਥੇ ਮੈਂ ਜਾਵਾਂ